ਸ਼ੋਸ਼ੇ ਸ਼ੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਅੱਜ ਹਰ ਕੋਈ ਚੀਜ਼ ਸ਼ੋਸ਼ਲ ਮੀਡੀਆ ਦੇ ਉੱਪਰ ਪਈ ਹੈ ਸੋ ਇਸ ਪ੍ਰਕਾਰ ਜਿੱਦਾਂ ਕਿ ਇਸ ਪਲੇਟਫਾਰਮ ਦੇ ਉੱਤੇ ਸ਼ਿਲਪਕਾਰੀ ਦੀ ਗੱਲ ਕਰੀਏ ਤਾਂ ਸ਼ਿਲਪਕਾਰੀ ਦੇ ਵਿੱਚ ਜਿਸ ਤਰ੍ਹਾਂ ਕਿ ਔਰਤਾਂ ਪੱਖੀਆਂ ਵਗੈਰਾ ਜਾਂ ਮੰਜੇ ਬੁਣਦੀਆਂ ਹਨ ਫੁਲਕਾਰੀ ਕੱਢਦੀਆਂ ਹਨ ਜੋ ਵੀ ਸ਼ਿਲਪਕਾਰੀ ਕਲਾ ਦੇ ਵਿੱਚ ਆਉਂਦਾ ਹੈ ਉਹਨੂੰ ਯੂਟੀਊਬ ਦੇ ਉੱਤਰ ਉੱਪਰ ਵੀਡੀਓ ਬਣਾ ਕੇ ਅਪਲੋਡ ਕਰ ਦਿੱਤੀ ਜਾਂਦੀ ਹੈ ਤਾਂ ਉਹ ਪੂਰੇ ਵਰਲਡ ਦੇ ਵਿੱਚ ਚੱਲੀ ਜਾਂਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕਾਂ ਦੁਆਰਾ ਉਸ ਨੂੰ ਦੇਖਿਆ ਜਾਂਦਾ ਹੈ ਅਤੇ ਜਿਸ ਦੇ ਵਿੱਚ ਜਿਸ ਦੇ ਕਰਕੇ ਉਸ ਦਾ ਕੋਈ ਘੇਰਾ ਨਹੀਂ ਰਹਿੰਦਾ ਅਤੇ ਵਰਲਡਵਾਈਡ ਉਹ ਸਾਡੀ ਸ਼ਿਲਪਕਾਰੀ ਜਿਹੜੀ ਹੈ ਲੋਕਾਂ ਕੋਲ ਲੋਕਾਂ ਕੋਲ ਪਹੁੰਚਦੀ ਹੈ ਅਤੇ ਲੋਕਾਂ ਨੂੰ ਵੀ ਇਹ ਦੇਖ ਕੇ ਅੱਛਾ ਲੱਗਦਾ ਹੈ ਅਤੇ ਲੋਕ ਵੀ ਸਾਡੀ ਮਤਲਬ ਕਿ ਇੱਕ ਰੀਸ ਦੇ ਨਾਲ ਉਸ ਚੀਜ਼ ਨੂੰ ਮਤਲਬ ਕਿ ਆਹ ਖੁਦ ਬਣਾਉਣ ਦੀ ਉਹ ਇੱਛਾ ਉਜਾਗਰ ਕਰਦੇ ਹਨ ਅਤੇ ਉਸ ਨੂੰ ਸਿੱਖਣ ਦੀ ਇੱਛਾ ਉਜਾਗਰ ਕਰਦੇ ਹਨ ਅਤੇ ਯੂਟੀਊਬ ਚੈਨਲਾਂ ਦੇ ਉੱਤੇ ਮਤਲਬ ਕਿ ਬਹੁਤ ਸਾਰੇ ਇੱਦਾਂ ਦੇ ਚੈਨਲ ਹਨ ਜਿੱਥੇ ਕਿ ਸ਼ਿਲਪਕਾਰੀ ਦੀਆਂ ਕਲਾਵਾਂ ਨੂੰ ਪੇਸ਼ ਕੀਤਾ ਜਾਂਦਾ ਹੈ